ਪਿਛਲੇ ਹਫਤੇ ਮੈਂ ਲੁਧਿਆਣਾ ਦੇ ਇੱਕ ਮੌਲ ਵਿੱਚ ਸ਼ੋਪਿੰਗ ਕਰਨ ਵਾਸਤੇ ਆਪਦੇ ਭੈਣ ਭਰਾ ਨਾਲ ਗਈ ਸੀ ਤੇ ਉੱਥੇ ਮੈਨੂੰ ਅਚਾਨਕ ਨਾਲ ਲਈ ਇੱਕ ਕੁੜੀ ਵੇਖੀ ਮੈਨੂੰ ਜਾਨੀ ਪਹਿਚਾਨੀ ਜਿਹੀ ਲੱਗੀ ਧਿਆਨ ਨਾਲ ਵੇਖਣ ਤੋਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਉਹ ਤਾਂ ਮੇਰੀ ਪੰਜਵੀਂ ਜਮਾਤ ਦੀ ਸਹੇਲੀ ਸੀ ਜੋ ਸਕੂਲ ਛੱਡ ਕੇ ਚਲੀ ਗਈ ਸੀ ਕੁਝ ਸਾਲ ਪਹਿਲੇ ਤੇ ਹੁਣ ਅਚਾਨਕ ਨਾਲ ਉਹਨੂੰ ਵੇਖਣ ਤੇ ਮੈਨੂੰ ਇਨੀ ਖੁਸ਼ੀ ਹੋਈ ਤੇ ਨਾਲ ਹੀ ਇਹ ਵਧੀਆ ਗੱਲ ਸੀ ਕਿ ਉਹਨੇ ਵੀ ਮੈਨੂੰ ਬਹੁਤ ਪਿਆਰ ਨਾਲ ਅਤੇ ਸਤਿਕਾਰ ਨਾਲ ਬੁਲਾਇਆ ਫਿਰ ਅਸੀਂ ਕੁਝ ਘੰਟੇ ਬਹਿ ਕੇ ਗੱਲਬਾਤ ਕੀਤੀ ਮੈਂ ਉਹਨੂੰ ਸਕੂਲ ਛੱਡਣ ਦਾ ਕਾਰਨ ਵੀ ਪੁੱਛਿਆ ਤਾਂ ਉਹਨੇ ਦੱਸਿਆ ਕਿ ਉਹਦੇ ਫਾਦਰ ਦੀ ਟ੍ਰਾਂਸਫਰ ਹੋ ਗਈ ਸੀ ਤਾਂ ਕਰਕੇ ਉਹਨੂੰ ਸਕੂਲ ਛੱਡਣਾ ਪਿਆ ਹਨਾ ਫਿਰ ਅਸੀਂ ਹੋਰ ਵੀ ਗੱਲਾਂ ਕੁਝ ਸਾਂਝੀਆਂ ਕੀਤੀਆਂ ਉਹਨੇ ਆਹ ਵੀ ਦੱਸਿਆ ਕਿ ਉਹਦੇ ਭਰਾ ਦਾ ਹੁਣ ਕੁਛ ਦਿਨਾਂ ਵਿੱਚ ਹੀ ਵਿਆਹ ਹੈ ਤੇ ਉਹਨੇ ਮੈਨੂੰ ਉਥੇ ਆਉਣ ਦੀ ਨਿਓਤਾ ਵੀ ਦਿੱਤਾ ਹੈ ਤੇ ਮੈਂ ਫਿਰ ਆਹ ਗੱਲ ਕਰਿਆ ਕਿ ਆਪਦੇ ਮਾਂ ਬਾਪ ਨਾਲ ਸਾਂਝੀ ਕੀਤੀ ਉਹ ਵੀ ਬਹੁਤ ਖੁਸ਼ ਹੋਏ ਅਤੇ ਸਾਨੂੰ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗਿਆ ਉਹਦੇ ਨਾਲ ਮਿਲ ਕੇ